ਮੈਂ ਅਤੇ ਮੇਰਾ ਪਰਿਵਾਰ ਹਰਿਆ ਭਰਿਆ ਅਤੇ ਸਾਫ਼ ਵਾਤਾਵਰਣ ਦੀ ਰੱਖਿਆ ਲਈ ਹਰ ਮਹੀਨੇ ਇੱਕ ਪੇੜ ਲਾਉਂਦੇ ਹਨ ਸਾਡੇ ਘਰ ਦੇ ਨਾਲ ਹੀ ਇੱਕ ਪਾਰਕ ਬਣਿਆ ਹੋਇਆ ਹੈ ਅਸੀਂ ਉੱਧਰ ਜਾ ਕੇ ਹਰ ਮਹੀਨੇ ਪੇੜ ਲਾਉਂਦੇ ਹਨ ਤਾਂ ਕਿ ਉਹ ਸਾਫ਼ ਹਵਾ ਦੇ ਸਕੇ ਨਾਲੇ ਸਾਨੂੰ ਆਹਾ ਵੀ ਪਤਾ ਹੈ ਕਿ ਪੇੜ ਸਾਨੂੰ ਇੱਕ ਤਾਂ ਛਾਇਆ ਦਿੰਦਾ ਹੈ ਨਾਲ ਹੀ ਨਾਲ ਖਾਣ ਪੀਣ ਦਾ ਜਿਵੇਂ ਕਿ ਫ਼ਲ ਆਦਿ ਸਾਨੂੰ ਦਿੰਦਾ ਹੈ ਜੋ ਸਾਡੇ ਸਵਾਸਥ ਲਈ ਬਹੁਤ ਜ਼ਿਆਦਾ ਚੰਗੇ ਹੁੰਦੇ ਹਨ ਉੱਥੇ ਸੈਰ ਕਰਨ ਵਾਲੇ ਲੋਕ ਵੀ ਬਹੁਤ ਆਉਂਦੇ ਹਨ ਤਾਂ ਕਿ ਜੋ ਪੇੜ ਹੁੰਦਾ ਹੈ ਉਹ ਸ਼ੁੱਧ ਹਵਾ ਦਿੰਦੇ ਹਨ ਜੋ ਲੋਕ ਆਉਂਦੇ ਹਨ ਸੈਰ ਕਰਨ ਲਈ ਉਨ੍ਹਾਂ ਦਾ ਬਹੁਤ ਜ਼ਿਆਦਾ ਲਾਭ ਹੁੰਦਾ ਹੈ